ਖੇਡਾਂ ਸਾਡੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਖੇਡਣਾ ਵੀ ਆਪਣੇ ਆਪ ਵਿੱਚ ਕਲਾ ਹੈ ਖੇਡਾਂ ਜਦੋਂ ਬੱਚਾ ਸਕੂਲ ਵਿੱਚ ਪੜ੍ਹਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਖੇਡਾਂ ਆਪਣੇ ਸਕੂਲ ਤੋਂ ਹੀ ਸਟਾਰਟ ਕਰਦਾ ਹੈ ਜਦੋਂ ਮੈਂ ਸਕੂਲ ਟਾਈਮ ਵਿੱਚ ਪੜ੍ਹਦੀ ਹੁੰਦੀ ਸੀ ਤਾਂ ਮੈਂ ਵੀ ਇੱਕ ਕਬੱਡੀ ਦੀ ਖਿਡਾਰਨ ਸੀ ਅਤੇ ਮੈਨੂੰ ਵੀ ਮੇਰੇ ਪੀ ਟੀ ਮਾਸਟਰ ਵੱਲੋਂ ਗਾਈਡ ਕੀਤਾ ਜਾਂਦਾ ਸੀ ਅਤੇ ਸਾਨੂੰ ਰੋਜ਼ ਸਵੇਰੇ ਸਕੂਲ ਜਲਦੀ ਬੁਲਾਇਆ ਜਾਂਦਾ ਸੀ ਜਿਸ ਨਾਲ਼ ਸਾਨੂੰ ਖੇਡਾਂ ਦੇ ਹੋਰ ਨਵੀਆਂ ਤਕਨੀਕਾਂ ਬਾਰੇ ਪਤਾ ਚੱਲ ਸਕੇ ਜਦੋਂ ਸਕੂਲ ਤੋਂ ਬਾਅਦ ਵੀ ਅਸੀਂ ਘਰ ਵਾਪਸ ਆਉਣਾ ਤਾਂ ਸ਼ਾਮ ਵੇਲੇ ਗਰਾਉਂਡ ਵਿੱਚ ਖੇਡਣ ਜਾਣਾ ਜਿੱਥੇ ਬਹੁਤ ਸਾਰੀਆਂ ਹੋਰ ਕੁੜੀਆਂ ਵੀ ਖੇਡਣ ਆਉਂਦੀਆਂ ਹੁੰਦੀਆਂ ਸਨ ਪਰ ਅੱਜ ਕੱਲ੍ਹ ਤਾਂ ਜਿਵੇਂ ਦੇਖਦੇ ਹਾਂ ਕਿ ਬਹੁਤ ਸਾਰੇ ਸਪੋਰਟਸ ਕੰਪਲੈਕਸ ਬਣ ਗਏ ਹਨ ਜਿੱਥੇ ਬਹੁਤ ਸਾਰੀਆਂ ਖੇਡਾਂ ਖਿਡਾਈਆਂ ਜਾਂਦੀਆਂ ਹਨ ਜਿਵੇਂ ਕਿ ਬਾਸਕਿਟਵੋਲ ਫੁੱਟਬੋਲ ਹਾਕੀ ਬੈਡਮਿੰਟਨ ਖੋ ਖੋ ਵਗੈਰਾ ਹੋਰ ਕਾਫੀ ਤਰ੍ਹਾਂ ਦੀਆਂ ਖੇਡਾਂ ਖਿਡਾਈਆਂ ਜਾਂਦੀਆਂ ਹਨ ਖੇਡਾਂ ਸਿਰਫ ਇੱਕ ਖੇਡਣ ਲਈ ਨਹੀਂ ਸਾਨੂੰ ਬਲਕਿ ਮਾਨਸਿਕ ਅਤੇ ਤੰਦਰੁਸਤੀ ਸਰੀਰਕ ਤੰਦਰੁਸਤੀ ਵਿੱਚ ਵੀ ਬਹੁਤ ਜ਼ਿਆਦਾ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਖੇਡਾਂ ਹਰ ਇੱਕ ਵਿਅਕਤੀ ਨੂੰ ਖੇਡਣੀਆਂ ਚਾਹੀਦੀਆਂ ਹਨ